ਪਸ਼ੂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਸਾਨੂੰ ਇੱਕ ਜਗ੍ਹਾ ਚਾਹੀਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਵਧੀਆ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਸਾਡੇ ਇਲਾਕੇ ਵਿੱਚ ਬਹੁਤ ਖੁੱਲੀ ਜਗ੍ਹਾ ਹੈ ਮੇਰੇ ਕੁਛ ਸਹੇਲੀਆਂ ਨੇ ਕੁੱਤੇ ਰੱਖੇ ਹੋਏ ਹਨ ਕਿਸੇ ਨੇ ਬਿੱਲੀਆਂ ਵੀ ਰੱਖੀਆਂ ਹੋਈਆਂ ਹਨ ਅਤੇ ਉਹ ਕਿਸੇ ਨੇ ਤੋਤੇ ਛੀ ਚੂਹੇ ਸਭ ਕੁਛ ਰੱਖਿਆ ਹੋਇਆ ਹੈ ਸਾਡੇ ਖੇਤਰ ਦੇ ਬੱਚਿਆਂ ਨੂੰ ਪਸ਼ੂ ਪਾਲਣ ਦਾ ਬਹੁਤ ਸ਼ੌਂਕ ਹੈ ਮੈਨੂੰ ਵੀ ਬਹੁਤ ਮਜ਼ਾ ਆਉਂਦਾ ਹੈ ਜਦੋਂ ਮੈਂ ਸ਼ਾਮ ਨੂੰ ਫਰੀ ਹੁੰਦੀ ਹਾਂ ਤਾਂ ਮੈਂ ਉਹਨਾਂ ਨੂੰ ਖਿਲਾਣ ਵਾਸਤੇ ਜਾਂਦੀ ਹਾਂ ਉਹ ਸਾਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਅਸੀਂ ਪਸ਼ੂ ਪਸ਼ੂਆਂ ਨੂੰ ਦੁੱਧ ਸਾਡੇ ਘਰ ਦੇ ਬਾਹਰ ਇੱਕ ਕਾਲਾ ਕੁੱਤਾ ਹੈ ਮੈਂ ਹਮੇਸ਼ਾ ਉਸ ਨੂੰ ਦੁੱਧ ਅਤੇ ਰੋਟੀ ਪਾਉਂਦੀ ਹਾਂ ਜਦੋਂ ਉਹ ਜਿੱਥੇ ਮੈਂ ਜਾਂਦੀ ਹਾਂ ਮੇਰੇ ਨਾਲ ਨਾਲ ਜਾਂਦਾ ਹੈ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਉਹ ਸਾਨੂੰ ਇੰਝ ਲੱਗਦਾ ਹੈ ਜਿੱਦਾਂ ਸਾਡੇ ਘਰ ਦਾ ਹੀ ਜੀਅ ਹੋਵੇ ਤੇ ਸਾਨੂੰ ਹਰ ਇੱਕ ਨੂੰ ਪਸ਼ੂ ਪਾਲਣੇ ਚਾਹੀਦੇ ਹਨ ਪਸ਼ੂ ਸਾਨੂੰ ਦੁਆਵਾਂ ਦਿੰਦੇ ਹਨ ਉਹਨਾਂ ਨਾਲ ਘਰ ਵਿੱਚ ਬਰਕਤ ਪੈਂਦੀ ਹੈ ਇਸ ਲਈ ਪਸ਼ੂ ਪਾਲਣਾ ਚੰਗਾ ਹੁੰਦਾ ਹੈ